ਰੂਪਨਗਰ ਜ਼ਿਲ੍ਹੇ ਦੇ ਵਿੱਚ ਮੌਸਮ ਬਹੁਤ ਠੰਡਾ ਰਹਿੰਦਾ ਹੈ ਕਿਉਂਕਿ ਇੱਥੇ ਆਪਣਾ ਨਦੀਆਂ ਨਹਿਰਾਂ ਦਰਿਆ ਅਤੇ ਮੌਸਮ ਅਕਸਰ ਠੰਡਾ ਹੀ ਰਹਿੰਦਾ ਹੈ ਅਤੇ ਬਹੁਤ ਵਧੀਆ ਮੌਸਮ ਰਹਿੰਦਾ ਲੋਕ ਦੂਰੋਂ ਦੂਰੋਂ ਆ ਕੇ ਸੈਲਫੀਆਂ ਲੈਂਦੇ ਨੇ ਫੋਟੋਆਂ ਖਿਚਾਉਂਦੇ ਨੇ ਅਤੇ ਇੱਥੇ ਜਿਹੜਾ ਮੌਸਮ ਦਾ ਆਨੰਦ ਮਾਣਦੇ ਨੇ ਸਾਡੇ ਨੇੜੇ ਟਿੱਬੀ ਸਾਹਿਬ ਭੱਠਾ ਸਾਹਿਬ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਇੱਥੇ ਦਾ ਜਿਹੜਾ ਮੌਸਮ ਏ ਵਾਤਾਵਰਨ ਏ ਬਹੁਤ ਠੰਡਾ ਜਾ ਰਹਿੰਦਾ ਹੈ ਕਿ ਇੱਥੇ ਗੁਰੂ ਸਾਹਿਬ ਦੀਆਂ ਬੜੀਆਂ ਬਖਸ਼ੀਸ਼ਾਂ ਨੇ ਅਤੇ ਬੜੀ ਮਿਹਰ ਹੈ ਅਤੇ ਬਾਕੀ ਸਾਡਾ ਰੋਪੜ ਜਿਹੜਾ ਸ਼ਹਿਰ ਹੈ ਇਹ ਬੜਾ ਅਨੰਦਮਈ ਹੈ ਇਹ ਬੜਾ ਠੰਡਾ ਰਹਿੰਦਾ ਹੈ ਅਤੇ ਰੋਜ਼ਾਨਾ ਜਿਹੜਾ ਮੌਸਮ ਹੈ ਬਹੁਤ ਵਧੀਆ ਰਹਿੰਦਾ ਇੱਥੇ ਜਿਹੜਾ ਮੌਸਮ ਏ ਮੌਸਮ ਦੀ ਤਾਂ ਕਿਆ ਬਾਤ ਹੈ ਅਤੇ ਆਨੰਦ ਏ ਆਨੰਦ ਹੈ